ਫਤਿਹਗੜ੍ਹ ਸਾਹਿਬ ਵਿੱਚ ਜਿਹੜੇ ਕਿੱਤੇ ਅਤੇ ਕੈਰੀਅਰ ਆ ਜਿਹੜੇ ਉਹ ਲੋਕ ਜਿਸ ਤਰ੍ਹਾਂ ਖੇਤੀ ਕਰਨਾ ਇਹ ਅਪਣਾਉਂਦੇ ਹਨ ਬਾਕੀ ਜਿਹੜੇ ਕਿੱਤੇ ਆ ਇਹ ਆਰਥਿਕ ਅਤੇ ਜੀਵਨ ਢੰਗ ਵਿੱਚ ਯੋਗਦਾਨ ਜਿਸ ਤਰ੍ਹਾਂ ਵੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਤੀ ਦਾ ਯੋਗਦਾਨ ਮਿਲਦਾ ਵੀ ਖੇਤੀ ਕਰਕੇ ਬੱਚੇ ਆਪਣਾ ਅੱਗੇ ਜਾ ਮਤਲਬ ਉਹਨਾਂ ਨੂੰ ਮਿਲਦਾ ਸਹੂਲਤ ਵੀ ਆਪਾਂ ਪੈਸੇ ਦੀ ਜਿਸ ਤਰ੍ਹਾਂ ਆਪਣਾ ਜੀਵਨ ਕਿੱਦਾਂ ਲੰਘਾਉਣਾ ਜਿੱਦਾਂ ਲੋਕ ਬੱਚੇ ਬਾਹਰ ਨੂੰ ਜਾਂਦੇ ਨੇ ਇੱਥੇ ਬੱਚੇ ਆਪਣਾ ਖੇਤੀ ਵਗੈਰਾ ਕਰਕੇ ਨਵੀਆਂ ਨਵੀਆਂ ਸਹੂਲਤਾਂ ਸਿੱਖਦੇ ਨੇ ਇੱਥੇ ਆਈ ਟੀ ਆਈ ਵੀ ਆ ਬਾਕੀ ਇੱਥੇ ਜਿਹੜੇ ਕਾਲਜ ਆ ਕਾਫੀ ਇੰਜੀਨੀਅਰ ਕਾਲਜ ਨੇ ਇਥੋਂ ਬੱਚੇ ਪੜ੍ਹ ਕੇ ਇੰਜੀਨੀਅਰ ਪ੍ਰੋਫੈਸਰ ਲੱਗਦੇ ਨੇ ਅੱਗੇ ਕਾਲਜਾਂ ਦੇ ਵਿੱਚ ਟੀਚਰ ਲੱਗਦੇ ਨੇ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਮਤਲਬ ਕਾਲਜ ਕਾਫੀ ਜ਼ਿਆਦਾ ਨੇ ਜਿਹੜੇ ਜਿਵੇਂ ਕਾਫੀ ਦੂਰੋਂ ਦੂਰੋਂ ਬੱਚੇ ਇੱਥੇ ਪੜ੍ਹਨ ਆਉਂਦੇ ਆ ਅੱਗੇ ਜਾ ਕੇ ਉਹ ਇੰਜੀਨੀਅਰ ਬਣਦੇ ਆ ਕੋਈ ਬਾਹਰ ਜਾ ਕੇ ਬਣਦਾ ਕੋਈ ਇੱਥੇ ਬਣਦਾ ਕੋਈ ਆਪਣਾ ਬਿਜਨਸ ਤੋਰਦਾ ਫਤਿਹਗੜ੍ਹ ਸਾਹਿਬ ਨੇ ਬਹੁਤ ਜਾਣੀ ਕਿੱਤੇ ਦਿੱਤੇ ਹੋਏ ਨੇ ਬੱਚਿਆਂ ਨੂੰ ਇੱਥੇ ਜਿਹੜੇ ਸਿੱਖ ਕੇ ਜਾਂਦੇ ਨੇ ਆਪਣਾ ਕੁਛ ਨਾ ਕੁਛ